ਕੋਵਿਡ ਨਾਈਨਟੀਨ ਇੱਕ ਬਹੁਤ ਵੱਡੀ ਮਹਾਮਾਰੀ ਸਾਬਿਤ ਹੋਈ ਆਪਣੇ ਦੇਸ਼ ਵਿੱਚ ਇਸ ਕਾਰਨ ਆਪਣੀ ਇੱਕ ਭਾਰਤ ਸਰਕਾਰ ਨੇ ਲੋਕਡਾਊਨ ਵੀ ਲਗਾਇਆ ਤੇ ਇਹ ਲੋਕਡਾਊਨ ਹਰ ਕਿਤੇ ਸਾਡੇ ਖੇਤਰ ਵਿੱਚ ਵੀ ਲੱਗਿਆ ਜਿਸ ਕਾਰਨ ਅਸੀਂ ਮਤਲਬ ਲੋਕਡਾਊਨ ਕਾਰਨ ਅਸੀਂ ਘਰੇ ਹੀ ਰਹਿੰਦੇ ਸੀ ਸਾਡਾ ਬਾਹਰ ਜਾਣਾ ਬਾਹਰੋਂ ਕਿਸੇ ਦਾ ਅੰਦਰ ਆਉਣਾ ਇਹ ਸਭ ਮਨ੍ਹਾ ਸੀਗਾ ਅਤੇ ਜਿਸ ਕਰਕੇ ਹੁਣ ਜੇ ਮਨ੍ਹਾ ਸੀ ਤਾਂ ਫਿਰ ਆਪਾਂ ਕਿਤੇ ਬਾਹਰ ਨਹੀਂ ਜਾ ਸਕਦੇ ਸੀ ਆਪਾਂ ਨੂੰ ਬਹੁਤ ਜ਼ਿਆਦਾ ਔਖਾ ਵੀ ਹੋਇਆ ਕਿਉਂਕਿ ਸਮਾਨ ਅਕਸਰ ਘਰ ਦਾ ਲਿਆਉਣਾ ਕਰਨਾ ਇਹ ਸਭ ਬਹੁਤ ਜ਼ਰੂਰੀ ਸੀ ਪਰ ਇ ਕੁਛ ਦਿਨ ਵਿੱਚ ਮਤਲਬ ਇੱਕ ਦੋ ਦੁਕਾਨਾਂ ਰੋਜ਼ ਖੋਲ੍ਹੀਆਂ ਜਾਂਦੀਆਂ ਸੀਗੀਆਂ ਇਹਦੇ ਨਾਲ ਦੁਕਾਨਾਂ ਦੇ ਤਾਂ ਚਲੋ ਅਲੱਗ ਗੱਲ ਹੈ ਪਰ ਜਿਵੇਂ ਕਿ ਇ ਸਥ ਸਥਿਤੀ ਕਿਵੇਂ ਸੀ ਲੋਕਾਂ ਦੀ ਸਥਿਤੀ ਐਵੇਂ ਸੀ ਕਿ ਜਿਵੇਂ ਲੋਕ ਬਹੁਤ ਜ਼ਿਆਦਾ ਬਿਮਾਰ ਹੋ ਰਹੇ ਸੀ ਸਾਂਦਾ ਖਾਂਸੀ ਜੁਕਾਮ ਹੀ ਉਹਨਾਂ ਦੇ ਗਲੇ ਵਿੱਚ ਖਰਾਸ਼ ਹੁੰਦੀ ਸੀ ਅਤੇ ਜਿਸ ਕਰਕੇ ਲੋਕ ਲੋਕਾਂ ਦੀ ਮੌਤ ਬਹੁਤ ਜ਼ਿਆਦਾ ਗਿਣਤੀ 'ਚ ਹੋਈ ਜਾ ਰਹੀ ਸੀ ਲੋਕਾਂ ਦੀ ਮੌਤ ਬਹੁਤ ਜ਼ਿਆਦਾ ਗਿਣਤੀ 'ਚ ਹੋਈ ਜਾ ਰਹੀ ਸੀ ਇਸ ਕਰਕੇ ਹੀ ਭਾਰਤ ਸਰਕਾਰ ਨੇ ਵੀ ਲੋਕ ਇੱਕ ਦੂਸਰੇ ਤੋਂ ਦੂਰ ਰਹਿਣ ਇਸ ਕਰਕੇ ਲੋਕਡਾਊਨ ਲਾਇਆ ਸੀ ਲੋਕਡਾਊਨ ਐਵੇਂ ਸੀ ਆ ਮੈਂ ਆਪਦੇ ਪਰਿਵਾਰ ਦੀ ਰੱਖ ਸੁਰੱਖਿਆ ਕਰਨ ਲਈ ਮੈਂ ਆਪਣੇ ਪਰਿਵਾਰ ਦੀ ਸੁਰੱਖਿਆ ਕਰਨ ਲਈ ਇੱਕ ਤਾਂ ਮਾਸਕ ਇੱਕ ਸੈਨੀਟਾਈਜ਼ਰ ਅਤੇ ਅਸੀਂ ਫ ਭੀੜ ਭੜਾਕੇ ਵਾਲੀ ਜਗ੍ਹਾ 'ਤੇ ਜਾਣਾ ਬੰਦ ਕੀਤਾ ਭੀੜ ਭੜਾਕੇ ਦੀ ਜਗ੍ਹਾ ਵਿੱਚ ਜਾਣਾ ਬੰਦ ਕੀਤਾ ਅਤੇ ਆਪਣੇ ਹੱਥ ਲਗਾਤਾਰ ਸੈਨੀਟਾਈਜ਼ ਕੀਤੇ ਆਪਣੇ ਹੱਥ ਅੱਖਾਂ ਨੱਕ ਮੂੰਹ ਨੂੰ ਛੂਹਣਾ ਬਾਰ ਬਾਰ ਬੰਦ ਕੀਤਾ ਅਤੇ ਇਹ ਧਿਆਨ ਰੱਖਿਆ ਕਿ ਜਿਹੜਾ ਵੀ ਅਸੀਂ ਸਮਾਨ ਬਾਜ਼ਾਰੋਂ ਲੈ ਕੇ ਆ ਰਹੇ ਹਾਂ ਉਹਨੂੰ ਪੂਰੇ ਤਰੀਕੇ ਸੈਨੀਟਾਈਜ਼ ਕਰੀਏ ਅਤੇ ਫਿਰ ਉਸ ਦਾ ਇਸਤੇਮਾਲ ਕਰੀਏ ਅਤੇ ਬਾਹਰ ਜਾਣ 'ਤੇ ਰੋਕ ਲੱਗੀ ਅਤੇ ਫਾਲਤੂ ਟਰੈਫਿਕ ਵਗੈਰਾ ਇਹਨਾਂ ਜਗ੍ਹਾ 'ਤੇ ਜ਼ਿਆਦਾ ਨਹੀਂ ਗਏ ਇਸੇ ਕਰਕੇ ਬਸ ਅਸੀਂ ਆਪ ਅਸੀਂ ਮੈਂ ਅਤੇ ਮੇਰਾ ਪਰਿਵਾਰ ਬਚੇ ਰਹੇ ਹਾਂ ਅਤੇ ਅਸੀਂ ਸਾਡੇ ਬ ਬਹੁਤ ਸਾਰੇ ਗੁਆਂਢੀ ਵੀ ਇਹੀ ਸਭ ਚੀਜ਼ਾਂ ਦੇਖਦੇ ਰਹੇ ਜਿਸ ਕਰਕੇ ਵੀ ਮਤਲਬ ਉਹਨਾਂ ਨੂੰ ਵੀ ਕੋ ਕੋਵਿਡ ਮਹਾਮਾਰੀ ਤੋਂ ਬਚੇ ਰਹੇ ਅਤੇ ਐਵੇਂ ਸਾਰੇ ਬਚੇ ਰਹਿਣ ਬਚੇ ਰਹਿਣ ਕਰਕੇ ਡਬਲਯੂ ਐਚ ਓ ਨੇ ਵੀ ਇਹ ਸਭ ਨਿਯਮ ਲਾਗੂ ਕੀਤੇ ਸੀ ਜਿਸ ਕਰਕੇ ਸਾਰੇ ਬਚੇ ਰਹੇ ਅਤੇ ਮੋਦੀ ਸਰਕਾਰ ਨੇ ਵੀ ਵਾ ਵਾ ਇੱਦਾਂ ਸਪੋਰਟ ਕੀਤਾ ਜਿਸ ਕਰਕੇ ਇਹਦਾ ਇਹਦੇ ਵਿੱਚ ਪੂਰੀ ਆਪਦੀ ਭੂਮਿਕਾ ਨਿਭਾਈ ਜਿਸ ਕਰਕੇ ਸਾਰੇ ਮਤਲਬ ਕੋਵਿਡ ਨਾਈਨਟੀਨ ਤੋਂ ਬਚੇ ਰਹੇ